ਵੈਸੇ ਤਾਂ ਜਿੱਦਾਂ ਹੁਣ ਮੈਂ ਆਪਾਂ ਪੰਜਾਬ 'ਚ ਰਹਿੰਦੇ ਸੀਗੇ ਪਹਿਲਾਂ ਤਾਂ ਪੰਜਾਬ 'ਚ ਰਹਿੰਦੇ ਟਾਈਮ ਮੈਂ ਪਹਿਲਾਂ ਤਾਂ ਪਤਾ ਜਿੱਦਾਂ ਸੂਇਆਂ ਵਗੈਰਾ 'ਤੇ ਜਿਹੜੇ ਹੁੰਦੇ ਸੀਗੇ ਜਿਹੜੇ ਹਲੇ ਤਲਾਬ ਤਲੁਬ ਹੁੰਦੇ ਸੀਗੇ ਪਿੰਡਾਂ ਵਿੱਚ ਹੁੰਦੇ ਸੀਗੇ ਜਾਂ ਫਿਰ ਸ਼ਹਿਰਾਂ 'ਚ ਹੁੰਦੇ ਸੀਗੇ ਦਰਿਆਵਾਂ ਵਗੈਰਾ 'ਤੇ ਇੱਥੇ ਆਪਾਂ ਪਹਿਲਾਂ ਪਿੰਡਾਂ 'ਚੋਂ ਸਿੱਖ ਕੇ ਆਪਾਂ ਦਰਿਆਵਾਂ ਵਗੈਰਾ 'ਤੇ ਵੀ ਇੱਥੇ ਤਾਰੀ ਵਗੈਰਾ ਲਾਈ ਹੈਗੀ ਹੈ ਉਹ ਤੋਂ ਇਲਾਵਾ ਜਿੱਦਾਂ ਮੈਂ ਜਿਹੜੀ ਮੇਨ ਹੈਗਾ ਏ ਉੱਥੋਂ ਮੈਂ ਇੱਥੇ ਇਟਲੀ 'ਚ ਵੀ ਜਿੱਦਾਂ ਮੈਂ ਰਹਿੰਦਾ ਰਹਿੰਦਾ ਸੀਗਾ ਉੱਥੇ ਮੈਂ ਨਾਈਨ ਪੁਆਇੰਟ ਚੈਨਲ 'ਤੇ ਉੱਥੇ ਮੈਂ ਤੈਰਾਕੀ ਮਤਲਬ ਤੈਰਾਕੀ ਬੱਚਿਆਂ ਨੂੰ ਵੀ ਸਿਖਾਉਂਦਾ ਹੁੰਦਾ ਸੀਗਾ ਜਿਹੜੀ ਹੁਣ ਇਹੀ ਹੈ ਮ ਆਪਣੇ ਮੈਂ ਪੋਤੇ ਨੂੰ ਵੀ ਤਰੱਕ ਤੈਰਾਕੀ ਸਿਖਾਈ ਸੀਗੀ ਜਿੱਦਾਂ ਹੁਣ ਇੱਕ ਵਾਰੀ ਮੈਂ ਉੱਥੇ ਨਾਈਨ ਪੁਆਇੰਟ ਚੈਨਲ 'ਤੇ ਮੈਂ ਉੱਥੇ ਤੈਰ ਰਿਹਾ ਸੀਗਾ ਸਵੀਮਿੰਗ ਕਰ ਰਿਹਾ ਸੀਗਾ ਮੈਂ ਉੱਥੇ ਜਦੋਂ ਮੈਂ ਉੱਥੇ ਦੇਖਿਆ ਕੋਈ ਬੰਦ ਕੋਈ ਬੱਚਾ ਇੱਕ ਬੱਚਾ ਸੀਗਾ ਉੱਥੇ ਮਤਲਬ ਦੋ ਬੱਚੇ ਆਪਸ 'ਚ ਲੜ ਰਹੇ ਸੀਗੇ ਇੱਕ ਉਹਨੇ ਬੱਚੇ ਨੇ ਮਤਲਬ ਦੂਜੇ ਨੂੰ ਉੱਥੇ ਉਹਦੇ ਇੱਕ ਪਰ ਪੁਲ ਬਣਿਆ ਹੋਇਆ ਸੀਗਾ ਇੱਕ ਉੱਥੇ ਇੱਕ ਬੱਚੇ ਨੇ ਲੜਦੇ ਲੜਦੇ ਨਾ ਦੂਜੇ ਨੂੰ ਧੱਕਾ ਮਾਰ ਦਿੱਤਾ ਉਹ ਥੱਲੇ ਗਿਰ ਗਿਆ ਉਸ ਬੱਚੇ ਨੂੰ ਮਤਲਬ ਹੱਥ ਪੈਰ ਮਾਰਨ ਲਾ ਪਿਆ ਮੈਨੂੰ ਪਹਿਲਾਂ ਤਾਂ ਲੱਗਿਆ ਬੱਚੇ ਨੂੰ ਤ ਬੱਚੇ ਨੂੰ ਤੈਰਾਨਾ ਆਉਂਦਾ ਹੋਵੇਗਾ ਜਦੋਂ ਹੱਥ ਪੈਰ ਮਾਰਨ ਲੱਗ ਗਿਆ ਤਾਂ ਮੈਨੂੰ ਇੱਦਾਂ ਲੱਗਿਆ ਵੀ ਉਹਨੂੰ ਬੱਚੇ ਨੂੰ ਤੈਰਨਾ ਆਉਂਦਾ ਨਹੀਂ ਮੈਂ ਭੱਜ ਕੇ ਜਾ ਕੇ ਬੱਚੇ ਨੂੰ ਬਚਾਇਆ ਅਤੇ ਉਹਨੂੰ ਬੱਚੇ ਨੂੰ ਜਦੋਂ ਬਚਾ ਕੇ ਮੈਂ ਬਾਹਰ ਕੱਢਿਆ ਤਾਂ ਬੱਚੇ ਨੇ ਮੇਰਾ ਬਹੁਤ ਬਹੁਤ ਧੰਨਵਾਦ ਕੀਤਾ ਤਾਂ ਮੇਰਾ ਵੀ ਐਕਸਪੀਰੀਅੰਸ ਇਹਦੇ ਨਾਲ ਮਤਲਬ ਔਖੀ ਘੜੀ ਵਿੱਚ ਮੈਨੂੰ ਵੀ ਲੱਗਿਆ ਬਈ ਉਹਦੀ ਬੱਚੇ ਦੀ ਮਦਦ ਕਰਕੇ ਮੈਂ ਵਧੀਆ ਕੀਤਾ ਇ ਇਹ ਮੈਂ ਬੱਚੇ ਦੀ ਇਸ ਤਰ੍ਹਾਂ ਮਤਲਬ ਮੈਂ ਉਹਦੀ ਮਦਦ ਕੀਤੀ ਹੈਗੀ ਹੇ